ਪੰਜਾਬੀ ਭਾਸ਼ਾ ਵਿਲੱਖਣ ਭਾਸ਼ਾ ਹੈ ਜਿਸਨੂੰ ਕਿ ਅਸੀਂ ਪੰਜਾਬੀ ਵਿੱਚ ਬੋਲਦੇ ਕੁਝ ਹੋਰ ਹਾਂ ਅਤੇ ਇਹ ਲਿਖੀ ਕੁਝ ਹੋਰ ਤਰ੍ਹਾਂ ਜਾਂਦੀ ਹੈ ਇਸਨੂੰ ਗੁਰਮੁਖੀ ਲਿੱਪੀ ਵਿੱਚ ਲਿਖਿਆ ਜਾਂਦਾ ਹੈ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਪੁਆਧੀ ਮਾਲਵੀ ਅਤੇ ਮਾਝੀ ਆ ਅਤੇ ਇਹ ਕੁਝ ਵੀ ਦ ਹਰ ਵੀਹ ਤੀਹ ਕਿਲੋਮੀਟਰ 'ਤੇ ਇਸਨੂੰ ਅਲੱਗ ਅਲੱਗ ਭਾਸ਼ਾਵਾਂ ਵਿੱਚ ਤੁਸੀਂ ਸੁਣੁਗੇ ਅਤੇ ਅਲੱਗ ਅਲੱਗ ਭਾਸ਼ਾ ਵਿੱਚ ਹੀ ਚੇਂਜ਼ ਹੁੰਦੇ ਰਹਿੰਦੇ ਹੈ ਵੀਹ ਤੀਹ ਕਿਲੋਮੀਟਰ 'ਤੇ ਜਿਵੇਂ ਕਿ ਅਸੀਂ ਰੋਪੜ ਵਿੱਚ ਘਰ ਨੂੰ ਜ਼ਿਆਦਾਤਰ ਘਰਾਂ ਹੀ ਵਿੱਚ ਘਰਾਂ ਹੀ ਕਹਿੰਦੇ ਹਨ ਘਰਾਂ ਹੀ ਕਹਿੰਦੇ ਹਾਂ ਅਤੇ ਅਗਰ ਤੁਸੀਂ ਪਟਿਆਲੇ ਵੱਲ ਜਾਉਗੇ ਤਾਂ ਪਟਿਆਲੇ ਦੇ ਇਲਾਕੇ ਵਿੱਚ ਹਰੇਕ ਸ਼ਬਦ ਦੇ ਲਾਸਟ ਵਿੱਚ ਸੀ ਕਹਿੰਦੇ ਹਾਂ ਜਿਵੇਂ ਆਇਆ ਸੀ ਕੰਮ ਕਰਦਾ ਸੀ ਕਹਿੰਦੇ ਹਾਂ ਜਦੋਂ ਅਸੀਂ ਅੰਬਰਸਰ ਵੱਲ ਜਾਈਏ ਤਾਂ ਉੱਥੇ ਹਰੇਕ ਕੰਮ ਵਿੱਚ ਡਿਆਂ ਲਾਉਂਦੇ ਹਾਂ ਜਿਵੇਂ ਕੰਮ ਕਰਦਾ ਡਿਆਂ ਸੀ ਕਰਨਡਿਆਂ ਸੀ ਇਵੇਂ ਦੀ ਵਰਤੋਂ ਹੁੰਦੀ ਆ ਅਤੇ ਇਹ ਭਾਸ਼ਾ ਹਰ ਇਲਾਕੇ ਵਿੱਚ ਚੇਂਜ ਹੁੰਦੀ ਰਹਿੰਦੀ ਹੈ